ਹਾਂ ਸਾਨੂੰ ਲੱਗਦਾ ਹੈ ਨਿਊਜ਼ ਮੀਡੀਆ ਪੇਂਡੂ ਖੇਤਰ ਵਿੱਚ ਕਾਫੀ ਮੁੱਦੇ ਦਿਖਾ ਰਿਹਾ ਹੈ ਪੇਂਡੂ ਪੱਧਰ ਤੇ ਜਾਂ ਅਖਬਾਰਾਂ ਦੇ ਵਿੱਚ ਅਕਸਰ ਅਸੀਂ ਅੱਜ ਕੱਲ ਦੇਖਦੇ ਹਾਂ ਪੇਂਡੂ ਪੱਧਰ ਤੇ ਪੰਜਾਬ ਦੀਆਂ ਕੁੜੀਆਂ ਜਾਂ ਗਰੀਬ ਰਿਕਸ਼ੇ ਵਾਲਾ ਜਾਂ ਆਟੋ ਚਲਾਉਣ ਵਾਲਾ ਆਟੋ ਚਲਾਉਣ ਵਾਲਾ ਵਿਅਕਤੀ ਉਹਨਾਂ ਦੇ ਬੱਚੇ ਯੂ ਪੀ ਐਸ ਪੀ ਸੀ ਐਸ ਕਲੀਅਰ ਕਰ ਰਹੇ ਹਨ ਪਾਸ ਕਰ ਰਹੇ ਹਨ ਤਾਂ ਇਸ ਨਾਲ ਦੂਜੇ ਹੋਰ ਗਰੀਬ ਪਰਿਵਾਰਾਂ ਨੂੰ ਕੀ ਆ ਹੌਸਲਾ ਮਿਲਦਾ ਹੈ ਅਤੇ ਇਸ ਤਰ੍ਹਾਂ ਦੀਆਂ ਖਬਰਾਂ ਨਾਲ ਪੰਜਾਬ ਦੇ ਪੇਂਡੂ ਪੱਧਰ ਦੇ ਵਿੱਚ ਪੜਨ ਨੂੰ ਲੈ ਕੇ ਬਹੁਤ ਜਾਗਰੂਕਤਾ ਵੱਧੀ ਹੈ ਅਤੇ ਅੱਜ ਕੱਲ ਦੇ ਸਮੇਂ ਦੇ ਵਿੱਚ

ਆਪਣੇ ਢੰਗ ਨਾਲ ਆਪਣੇ ਤਰੀਕੇ ਨਾਲ ਕੀ ਐ ਪੈਸੇ ਕਮਾ ਰਹੇ ਹਨ ਅਤੇ ਲੋਕਾਂ ਨੂੰ ਉਹ ਪ੍ਰੇਰਿਤ ਕਰ ਰਹੇ ਹਨ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਤੇ ਇਸ ਤਰ੍ਹਾਂ ਦੀਆਂ ਖਬਰਾਂ ਨਾਲ ਪੇਂਡੂ ਪੱਧਰ ਦੇ ਵਿੱਚ ਨਵੇਂ ਨੌਜਵਾਨ ਮੁੰਡਿਆਂ ਦੇ ਵਿੱਚ ਕੁੜੀਆਂ ਦੇ ਵਿੱਚ ਆਪਣੇ ਕੰਮ ਨੂੰ ਲੈ ਕੇ ਪ੍ਰੇਰਨਾ ਹੋਰ ਵਧੀਆ ਹੈ ਅਤੇ ਏ ਇਸ ਤਰ੍ਹਾਂ ਖਬਰਾਂ ਨਾਲ ਇਸ ਤਰ੍ਹਾਂ ਦੀਆਂ ਖਬਰਾਂ ਛਾਪਣ ਨਾਲ ਪੰਜਾਬ ਦਾ ਜਿਹੜਾ ਪੰਜਾਬ ਦਾ ਪੇਂਡੂ ਪੱਧਰ ਹੈ ਉਹ ਸਮਾਂ ਆ ਜਾਏ ਉਹ ਵਿਕਸਿਤ ਦੇ ਰਾਹ ਵੱਲ ਜਾ ਰਿਹਾ ਹੈ ਅਤੇ ਕੁਝ ਅਸੀਂ ਮੰਨ ਸਕਦੇ ਹਾਂ ਤੇ ਕੁਝ ਖਬਰਾਂ ਮੀਡੀਆ ਇਸ ਤਰ੍ਹਾਂ ਦੀਆਂ ਵੀ ਛਾਪ ਦਿੰਦਾ ਹੈ ਕਿ ਜਿਹੜੀਆਂ ਮੀਡੀਆ ਨੂੰ ਅਖਬਾਰ ਜਾਂ ਨਿਊਜ਼ ਪੇਪਰਾਂ ਦੇ ਵਿੱਚ ਜਾਂ ਟੈਲੀਵਿਜ਼ਨਾਂ ਦੇ ਵਿੱਚ ਰੇਡੀਓ ਦੇ ਉੱਪਰ ਛਾਪਣੀਆਂ ਨਹੀਂ ਚਾਹੀਦੀਆਂ ਜਿਵੇਂ ਕੋਈ ਲੜਕੀ ਲੜਕੀ ਜਿਹੜੀ ਪੜ੍ਹਨ ਲਈ ਉਹਨੂੰ ਘਰੋਂ ਨਾ ਜਾਣ ਦੇਣਾ ਜਾਂ ਪਰੰਪਰਾਵਾਦੀ ਸੋਚ ਹੋਣਾ ਬੈਕਵਰਡ ਜਾਂ ਪਰੰਪਰਾਵਾਦੀ ਸੋਚ ਹੋਣ ਕਰਕੇ ਕੁੜੀਆਂ ਨੂੰ ਸ਼ਹਿਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਪੜ੍ਹਨ ਲਈ ਨਹੀਂ ਭੇਜਿਆ ਜਾਂਦਾ ਉਹ ਸਮਝਦੇ ਹਨ ਕਿ ਕੁੜੀਆਂ ਪਿੰਡਾਂ ਵਿੱਚ ਪਿੰਡਾਂ ਤੋਂ ਸ਼ਹਿਰਾਂ ਵੱਲ ਜਦੋਂ ਜਾਣਗੀਆਂ ਤਾਂ ਉਹ ਕੀ ਐ ਵਿਗੜ ਜਾਣਗੀਆਂ ਅਤੇ ਇਸ ਤਰ੍ਹਾਂ ਦੀਆਂ ਜਦੋਂ ਖਬਰਾਂ ਛਪਦੀਆਂ ਹਨ ਤਾਂ ਪੇਂਡੂ ਪੱਧਰ ਦੇ ਵਿੱਚ ਅਨਪੜਤਾ ਹੋਣ ਕਰਕੇ ਦੂਜੇ ਲੋਕਾਂ ਤੇ ਵੀ ਨਕਾਰਤਮਿਕ ਪ੍ਰਭਾਵ ਪੈਂਦਾ ਹੈ ਅਤੇ ਉਹ ਵੀ ਆਪਣੀਆਂ ਧੀਆਂ ਨੂੰ ਬੇਟੀਆਂ ਨੂੰ ਪੜ੍ਹਨ ਤੋਂ ਰੋਕਦੇ ਹਨ ਅਤੇ ਮੀਡੀਆ ਨੂੰ ਇਸ ਤਰ੍ਹਾਂ ਦੀਆਂ ਖਬਰਾਂ ਨਹੀਂ ਛਾਪਣੀਆਂ ਚਾਹੀਦੀਆਂ ਕੁਝ ਅਜਿਹੀਆਂ ਖਬਰਾਂ ਵੀ ਮੀਡੀਆ ਛਾਪਦਾ ਹੈ ਜਿਵੇਂ ਆਪਾਂ ਅਕਸਰ ਅਖਬਾਰਾਂ ਟੈਲੀਵਿਜ਼ਨਾਂ ਵਿੱਚ ਸੁਣਦੇ ਹਾਂ ਕਿ ਇੱਕ ਵਿਅਕਤੀ ਤੋਂ ਪੰਜਾਹ ਲੱਖ ਰੁਪਿਆ ਦਾ ਚਿੱਟਾ ਫੜਿਆ ਗਿਆ ਹੀਰੋਇਨ ਫੜੀ ਗਈ ਤਾਂ ਉਹ ਦਿਨੋਂ ਦਿਨ ਅਮੀਰ ਹੋ ਗਿਆ ਦਿਨੋਂ ਦਿਨ ਅਮੀਰ ਹੋ ਗਿਆ ਤਾਂ ਇਹਦੇ ਨਾਲ ਕੀ ਐ ਨੌਜਵਾਨਾਂ ਦੇ ਵਿੱਚ ਕੀ ਐ ਸਖਤ ਮਿਹਨਤ ਕਰਨ ਦੀ ਐ ਜਿਹੜੀ ਜਿਹੜੀ ਇੱਛਾ ਹੁੰਦੀ ਐ ਉਹ ਖਤਮ ਹੁੰਦੀ ਜਾ ਰਹੀ ਹੈ ਕਿਵੇਂ ਕੀ ਆ ਆਪਾਂ ਦੋ ਕਿਲੋ ਹੀਰੋਇਨ ਵੇਚ ਦੋ ਜਾਂ ਕਿਲੋ ਚਿੱਟਾ ਵੇਚ ਦੋ ਤਾਂ ਆਪਾਂ ਕੀ ਐ ਦਿਨਾਂ ਦੇ ਵਿੱਚ ਹੀ ਜਾਂ ਰਾਤਾਂ ਦੇ ਵਿੱਚ ਹੀ ਕੀ ਐ ਅਮੀਰ ਹੋ ਜਾਵਾਂਗੇ ਤਾਂ ਇਸ ਤਰ੍ਹਾਂ ਦੀਆਂ ਖਬਰਾਂ ਮੀਡੀਆ ਨੂੰ ਨਹੀਂ ਛਾਪਣੀਆਂ ਚਾਹੀਦੀਆਂ ਅਤੇ ਮੀਡੀਆ ਦੇ ਵਿੱਚ ਅਸੀਂ ਅਕਸਰ ਸੁਣਦੇ ਹਾਂ ਕਿ ਅੱਜ ਕੱਲ ਮੀਡੀਆ ਦੇ ਵਿੱਚ ਤਾਂ ਕਰੰਟ ਦੇ ਵਿੱਚ ਤਾਂ ਬਹੁਤ ਚੱਲ ਰਹੀ ਐ ਕਿਵੇਂ ਵਿਆਹ ਦੇ ਵਿੱਚ ਲੋਕਾਂ ਨੇ ਕਰੋੜਾਂ ਰੁਪਈਆ ਖਰਚ ਕਰ ਦਿੱਤਾ ਗਿਆ ਤੇ ਅਤੇ ਜਿਹੜੇ ਮਿਡਲ ਕਲਾਸ ਦੇ ਮਿਡਲ ਕਲਾਸ ਦੀ ਫੈਮਿਲੀ ਐ ਮਿਡਲ ਪੱਧਰ ਤੇ ਜਿਹੜੇ ਲੋਕ ਆਏ ਜਾਂ ਗਰੀਬ ਪਰਿਵਾਰ ਐ ਉਹ ਵੀ ਕਈ ਸੋਚਦੇ ਆ ਕਿਵੇ ਅਸੀਂ ਵੀ ਬਹੁਤ ਜਿਆਦਾ ਵਿਆਹ ਦੇ ਖਰਚ ਕਰਾਂਗੇ ਆਪਾਂ ਕਰਜਾ ਲੈ ਲਵਾਂਗੇ ਤੇ ਆਪਾਂ ਬਹੁਤ ਕੁਝ ਵਿਆਹ ਦੇ ਵਿੱਚ ਕਰਾਂਗੇ ਇਹਦੇ ਕਰਕੇ ਇਹ ਲੋਕ ਪੈਸੇ ਦੇ ਕਰਜਈ ਹੋ ਜਾਂਦੇ ਆ ਤੇ ਲੋਕ ਸੁਸਾਈਡ ਕਰਨ ਜਾਂ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਂਦੇ ਆ ਅਤੇ ਇਸ ਤਰ੍ਹਾਂ ਮੀਡੀਆ ਨੂੰ ਕੁਝ ਅਜਿਹੇ ਮੁੱਦਿਆਂ ਦੀ ਮੁੱਦਿਆਂ ਤੇ ਖਬਰਾਂ ਨਹੀਂ ਛਾਪਣੀਆਂ ਚਾਹੀਦੀਆਂ ਜਿਸ ਨਾਲ ਸਮਾਜ ਨਕਾਰਤਮਕ ਸੋਚ ਜਾਂ ਸਮਾਜ ਦਾ ਢਾਂਚਾ ਖਰਾਬ ਹੋ ਜਾਵੇ ਤਾਂ ਓਕੇ